ਚੌਦ੍ਹਾਂ ਫਰਵਰੀ ਦੋ ਹਜ਼ਾਰ ਤਿੰਨ ਅਠਾਈ ਮਾਰਚ ਉੱਨੀ ਸੌ ਅਠਾਨਵੇਂ ਇੱਕੀ ਅਪ੍ਰੈਲ ਦੋ ਹਜ਼ਾਰ ਇੱਕੀ ਪੰਜ ਮਈ ਦੋ ਹਜ਼ਾਰ ਬਾਰ੍ਹਾਂ ਸਤਾਰਾਂ ਜੂਨ ਉੱਨੀ ਸੌ ਨੜਿਨਵੇਂ